ਹੈਲੋ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਹੁਣ ਇੱਕ ਵੱਖਰੇ ਸ਼ਹਿਰ ਦੇ ਵਿੱਚ ਗਈ ਹੋਈ ਹਾਂ ਮਤਲਬ ਮੈਂ ਆਪਣੇ ਜਿਸ ਜਗ੍ਹਾ ਮੈਂ ਰਹਿੰਦੀ ਹਾਂ ਮੈਂ ਉਸ ਜਗ੍ਹਾ ਨਹੀਂ ਹਾਂ ਦੋ ਦਿਨ ਪਹਿਲਾਂ ਹੀ ਮੈਂ ਤੁਹਾਡੀ ਗੈਸ ਏਜੰਸੀ ਤੋਂ ਗੈਸ ਦੀ ਬੁਕਿੰਗ ਕਰਵਾਈ ਸੀ ਅਤੇ ਮੇਰੀ ਗੈਸ ਬੁਕਿੰਗ ਦਾ ਨੰਬਰ ਹੈ ਪੰਜ ਅੱਠ ਚਾਰ ਜੀਰੋ ਜੀਰੋ ਜੀਰੋ ਇੱਕ ਅੱਠ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀ ਜਿਹੜੀ ਗੈਸ ਦੀ ਬੁਕਿੰਗ ਆ ਰੱਦ ਕਰਵਾਉਣਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਇਸ ਸਮੇਂ ਗੈਸ ਦੀ ਲੋੜ ਨਹੀਂ ਹੈ ਜੇਕਰ ਕਿਉਂਕਿ ਜੇਕਰ ਤੁਸੀਂ ਮੇਰੇ ਘਰ ਗੈਸ ਭਿਜਵਾਉਂਦੇ ਵੀ ਹੋ ਤਾਂ ਮੇਰੇ ਘਰ ਕੋਈ ਵੀ ਉਸ ਸਮੇਂ ਨਹੀਂ ਹੋਏਗਾ ਅਤੇ ਮੈਂ ਚਾਹੁੰਦੀ ਹਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਏ ਇਸ ਲਈ ਜੋ ਤੁਸੀਂ ਮੇਰੀ ਗੈਸ ਦੀ ਬੁਕਿੰਗ ਹੈ ਰੱਦ ਕਰ ਦਿੱਤੀ ਜਾਵੇ ਅਤੇ ਜਦੋਂ ਮੈਂ ਆਪਣੇ ਘਰ ਵਾਪਸ ਆ ਜਾਵਾਂਗੀ ਤਾਂ ਮੈਂ ਗੈਸ ਦੀ ਬੁਕਿੰਗ ਫਿਰ ਤੋਂ ਦੁਬਾਰਾ ਕਰਵਾ ਲਵਾਂਗੀ ਇਹ ਜਦੋਂ ਮੈਨੂੰ ਲੋੜ ਹੋਏਗੀ ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੀ ਗੈਸ ਦੀ ਇਹ ਬੁਕਿੰਗ ਰੱਦ ਕਰ ਦੇਵੋ ਉਹ ਅਤੇ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਅਤੇ ਮੈਂ ਜਾਣ ਅਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਜੋ ਮੇਰੀ ਰੱਦ ਕਰਨ ਦੀ ਸਥਿਤੀ ਹੈ ਮਤਲਬ ਜੇ ਮੇਰੀ ਰੱਦ ਹੋ ਗਈ ਹੈ ਤਾਂ ਮੈਨੂੰ ਉਸਦੇ ਬਾਰੇ ਪੂਰੀ ਜਾਣਕਾਰੀ ਦੇ ਦਿੱਤੀ ਜਾਵੇ ਅਤੇ ਜੇਕਰ ਨਹੀਂ ਵੀ ਹੋਈ ਹੈ ਤਾਂ ਵੀ ਉਸ ਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਸਮੇਂ ਸਮੇਂ 'ਤੇ ਦੇ ਦਿੱਤੀ ਜਾਂਦੀ ਰਹੇ